ਜਦੋਂ ਮੈਂ ਧੁੰਦਲੀ ਸਵੇਰ ਹੱਥਾਂ ਵਿੱਚ ਦੂਰਬੀਨ ਲੈ ਚੁੱਪ ਚਾਪ ਬੈਠੀ ਸੀ ਤਾਂ ਮੈਨੂੰ ਆਪਣੇ ਕੋਲ ਦੀਆਂ ਝਾੜੀਆਂ ਵਿੱਚ ਅਚਾਨਕ ਖੜਕਦੀ ਮਹਿਸੂਸ ਹੋਈ ਇੱਕ ਸ਼ਾਨਦਾਰ ਬਾਜ਼ ਉੱਡਿਆ ਇਸ ਦੀ ਮਨਾਹ ਵਾਲੀ ਨਿਗ੍ਹਾ ਮੇਰੇ ਉੱਤੇ ਤਾਲਾ ਲਗਾ ਰਹੀ ਸੀ ਅਸੀਂ ਉੱਥੇ ਬੈਠੇ ਇੱਕ ਸਾਂਝੇ ਫਲ ਵਿੱਚ ਜੰਮ ਗਏ ਜਿਵੇਂ ਕਿ ਸਾਡੇ ਆਲੇ ਦੁਆਲੇ ਦੀ ਦੁਨੀਆ ਪਿਘਲ ਗਈ ਬਾਜ਼ ਦੇ ਖੰਭ ਸਵੇਰ ਦੀ ਰੋਸ਼ਨੀ ਵਿੱਚ ਪਾਲਿਸ਼ ਕੀਤੇ ਪਿੱਤਲ ਵਾਂਗ ਚਮਕਦੇ ਹਨ ਸਨ ਅਤੇ ਮੈਂ ਅਜਿਹੇ ਸ਼ਕਤੀਸ਼ਾਲੀ ਜੀਵ ਤੋਂ ਸਿਰਫ ਇੰਚ ਹੋਣ ਦਾ ਮਹਿਸੂਸ ਕੀਤਾ ਇਹ ਇਸ ਤਰ੍ਹਾਂ ਸੀ ਜਿਵੇਂ ਸਮਾਂ ਰੁਕ ਗਿਆ ਸੀ ਅਤੇ ਮੈਂ ਕੁਦਰਤੀ ਸੰਸਾਰ ਨਾਲ ਇੱਕ ਸੀ ਅਚਾਨਕ ਬਾਜ਼ ਨੇ ਆਪਣੇ ਖੰਭ ਫੈਲਾਏ ਮੇਰੇ ਉੱਤੇ ਪਰਛਾਵਾਂ ਸੁੱਟਿਆ ਅਤੇ ਅਸਮਾਨ ਵੱਲ ਲੈ ਗਿਆ ਮੈਂ ਹੈਰਾਨ ਹੋ ਕੇ ਦੇਖਿਆ ਜਦੋਂ ਇਹ ਸਿਰ ਦੇ ਉੱਪਰ ਉੱਡਦਾ ਸੀ ਇਸ ਦੇ ਖੰਭਾਂ ਦੇ ਹੇਠਾਂ ਹਵਾ ਦੀ ਕਾਹਲੀ ਮਹਿਸੂਸ ਕਰਦਾ ਸੀ ਇਹ ਸੱਚਮੁੱਚ ਹੀ ਇੱਕ ਉੱਤਮ ਤਜ਼ਰਬਾ ਸੀ ਜਿਸ ਨੇ ਮੈਨੂੰ ਸਾਹ ਰੋਕ ਦਿੱਤਾ ਅਤੇ ਕੁਦਰਤ ਦੀ ਜੰਗਲੀ ਸੁੰਦਰਤਾ ਨਾਲ ਹੋਰ ਮੁਲਾਕਾਤਾਂ ਲਈ ਤਰਸਾਇਆ ਹਾਲਾਂਕਿ ਮੈਂ ਉਦੋਂ ਤੋਂ ਬਹੁਤ ਹੀ ਸਾਰੇ ਦੁਰਲੱਭ ਪੰਛੀਆਂ ਨੂੰ ਦੇਖਿਆ ਪਰ ਇਹ ਪਰ ਮੇਰੇ ਯਾਦ ਵਿੱਚ ਹਮੇਸ਼ਾ ਲਈ ਉਹ ਕਰਦਾ ਰਿਹਾ ਅਤੇ ਮੈਂ ਉੱਥੇ ਇੱਕ ਮੋਰ ਪੰਛੀ ਦੇਖਿਆ ਜੋ ਬਹੁਤ ਹੀ ਸੋਹਣਾ ਸੀ ਉਹਦੇ ਫ ਉਹਦੇ ਫੰਗ ਇੰਨੇ ਜ਼ਿਆਦਾ ਸੋਹਣੇ ਸਨ ਕਿ ਮੈਂ ਉਸ ਨੂੰ ਦੇਖਦੀ ਹੀ ਰਹਿ ਗਈ ਉਹ ਉਹ ਮਾਨਸੂਨ ਪੌਣਾਂ ਵਿੱਚ ਬਹੁਤ ਜ਼ਿਆਦਾ ਪੈਲਾਂ ਪਾਉਂਦਾ ਹੈ ਅਤੇ ਨੱਚਦਾ ਹੈ ਬਹੁਤ ਵਧੀਆ ਪੰਛੀ ਹੈ ਮੋਰ ਇੱਕ ਬਹੁਤ ਹੀ ਸੁੰਦਰ ਪੰਛੀ ਹੈ